ਬਹੁਤ ਸਾਰੀਆਂ ਨਵੀਨਤਮ ਖੇਡਾਂ ਹਨ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਤੈਰਾਕ ਸਾਈਕਲ ਚਲਾਉਣਾ ਬੋਕਸਿੰਗ ਸ਼ੂਟਿੰਗ ਕਿੱਕਬੋਲ ਔਰ ਗੋਲਫ ਇਹ ਬਹੁਤ ਸਾਰੀਆਂ ਖੇਡਾਂ ਹਨ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਖੇਡੀਆਂ ਜਾਂਦੀਆਂ ਹਨ ਔਰ ਕਈ ਇਹੋ ਜਿਹੀਆਂ ਖੇਡਾਂ ਹਨ ਜਿਹੜੀਆਂ ਅਸੀਂ ਪੇਂਡੂ ਖੇਤਰ ਵਿੱਚ ਵੀ ਖੇਡਦੇ ਹਾਂ ਜਿਵੇਂ ਕਿ ਗੁੱਲੀ ਡੰਡਾ ਖੋ ਖੋ ਛੂਹਣ ਛਪਾਈ ਔਰ ਬਹੁਤ ਸਾਰੀਆਂ ਕਈ ਹੋਰ ਅਜਿਹੀਆਂ ਖੇਡਾਂ ਹਨ ਜਿਹੜੀਆਂ ਅਸੀਂ ਆਪਣੇ ਪੇਂਡੂ ਖੇਤਰ ਵਿੱਚ ਖੇਡਦੇ ਹਾਂ ਔਰ ਇਹਨਾਂ ਨਵੀਨਤਮ ਖੇਡਾਂ ਬਾਰੇ ਸਾਨੂੰ ਟੀ ਵੀ ਨਿਊਜ਼ ਚੈਨਲ ਔਰ ਜਾਂ ਅਸੀਂ ਫੋਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਨਵੀਨਤਮ ਖੇਡਾਂ ਖੇਡੀਆਂ ਜਾਂਦੀਆਂ ਹਨ ਔਰ ਕਈ ਵਾਰ ਸ਼ਹਿਰਾਂ ਵਿੱਚ ਵੀ ਸਮਾਗਮਾਂ 'ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਨਵੀਨਤਮ ਖੇਡਾਂ ਖੇਡੀਆਂ ਜਾਂਦੀਆਂ ਹਨ ਔਰ ਅਸੀਂ ਕਈ ਪੇਂਡੂ ਖੇਤਰ ਵਿੱਚ ਹੋਰ ਵੀ ਕਈ ਅਜਿਹੀਆਂ ਖੇਡਾਂ ਹਨ ਜਿਹੜੀਆਂ ਅਸੀਂ ਖੇਡਦੇ ਹਾਂ